ਵੀ ਭਾਸ਼ਾ ਦੇ ਵਿੱਚ ਕੁਝ ਜਿਹੜੇ ਆਮ ਵਾਕੰਸ਼ ਹੈ ਜਿਹੜੇ ਰੋਜ਼ਾਨਾ ਵਰਤੇ ਜਾਂਦੇ ਹੈ ਸੀਤਾ ਕੱਪੜੇ ਧੋਂਦੀ ਹੈ ਰਾਮ ਸ਼ਹਿਰ ਚੱਲਿਆ ਹੈ ਦਲਜੀਤ ਝਾੜੂ ਲਗਾਉਂਦੀ ਹੈ ਮੈਂ ਸਕੂਲ ਚੱਲੀ ਹਾਂ ਇਹ ਜਿਹੜੇ ਆਮ ਵਾ ਵਾਕੰਸ਼ ਹੈ ਇਹ ਡੇਲੀ ਹਾ ਵਰਤੇ ਜਾਣ ਵਾਲੇ ਹੈ ਇਹਨਾਂ ਤੋਂ ਇਲਾਵਾ ਕੁਝ ਮੁਹਾਵਰੇ ਹੈ ਜਿਹੜੇ ਅਸੀਂ ਰੋਜ਼ਾਨਾ ਗੱਲਬਾਤ ਦੇ ਵਿੱਚ ਵਰਤਦੇ ਹਾਂ ਜਿਵੇਂ ਕਿ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਮੀਨਜ਼ ਜਦੋਂ ਕੋਈ ਬਿਨ ਸੱਦਿਆ ਮਹਿਮਾਨ ਕਿਸੇ ਦੇ ਘਰ ਜਾਂਦਾ ਹੈ ਸ ਫਿਰ ਉਹ ਦਿਨ ਡੁੱਬਾ ਜਦ ਘੋੜੀ ਚੜਿਆ ਕੁੱਬਾ ਇਹ ਖਾਣ ਛੋਲੇ ਡਕਾਰ ਬਦਾਮ ਦੇ ਨਾਤੀ ਧੋਤੀ ਰਹਿ ਗਈ ਮੂੰਹ 'ਤੇ ਮੱਖੀ ਬਹਿ ਗਈ ਮੀਨਸ ਕਿ ਨਹਾਤੀ ਧੋਤੀ ਰਹਿ ਗਈ ਜੇ ਕਿਸੇ ਜਗ੍ਹਾ 'ਤੇ ਜਾਣਾ ਹੋਵੇ ਉੱਥੇ ਉਸ ਤੋਂ ਨਾ ਪਹੁੰਚਿਆ ਗਿਆ ਹੋਵੇ ਆਟੇ ਦੇ ਨਾਲ ਘੁਣ ਵੀ ਪਿਸਦਾ ਹੈ ਸਿੰਘਾਂ ਨਾਲ ਦੋਸਤੀ ਪੂਛਾਂ ਨਾਲ ਵੈਰ ਸੌ ਸਿਆਣੇ ਇੱਕੋ ਮੱਤ ਮੂਰਖ ਆਪੋ ਆਪਣੀ